ਸਰੀਰਕ ਅਤੇ ਮਾਨਸਿਕ ਪ੍ਰਦਰਸ਼ਨ ਨੂੰ ਅਨੁਕੂਲ ਬਣਾਉਣ ਲਈ ਗਤਕਾ ਅਭਿਆਸ ਨਾਲ ਖਾਸ ਖੁਰਾਕਾਂ ਜਿਵੇਂ ਕਿ ਪੌਸ਼ਟਿਕ ਖੁਰਾਕ ਅਤੇ ਵਧੀਆ ਫ਼ਾਇਦੇਮੰਦ ਖੁਰਾਕਾਂ ਲੈਣੀਆਂ ਜ਼ਰੂਰੀ ਹਨ ਜੀਵਨਸ਼ੈਲੀ ਦੀਆਂ ਸਿਫ਼ਾਰਿਸ਼ਾਂ ਇਹ ਹਨ ਕਿ ਰੋਜ਼ ਗਤਕੇ ਦੀ ਪ੍ਰੈਕਟਿਸ ਕੀਤੀ ਜਾਵੇ ਅਤੇ ਸਾਨੂੰ ਪ੍ਰੋਪਰ ਸਮਾਂ ਦਿੱਤਾ ਜਾਵੇ